ਹੈਲੋ ਮੀਸੋ ਮੈਂ ਛਿੰਦਰਪਾਲ ਫਾਫਡੇ ਭਾਈਕੇ ਤੋਂ ਹਾਂ ਮੈ ਹਰ ਵਾਰ ਤੁਹਾਡੇ ਤੋਂ ਹੀ ਤੁਹਾਡੇ ਤੋਂ ਹੀ ਕੁਝ ਨਾ ਕੁਝ ਮੰਗਵਾਉਦੀ ਰਹਿੰਦੀ ਹਾਂ ਇਸ ਵਾਰ ਵੀ ਮੈਨੂੰ ਤੁਹਾਡੇ ਤੋਂ ਕੰਨਾਂ ਦੇ ਟੋਪਸ ਮੰਗਵਾਏ ਸੀ ਮੈਨੂੰ ਬਹੁਤ ਪਸੰਦ ਸੀ ਪਰ ਜਿਸ ਵੀ ਦਿਨ ਮੈਨੂੰ ਆਡਰ ਮਿਲਣਾ ਸੀ ਉਸ ਦਿਨ ਤੋਂ ਬਹੁਤ ਹੀ ਪਹਿਲਾਂ ਤੋਂ ਬਹੁਤ ਹੀ ਪਹਿਲਾਂ ਉਹ ਮਿਲ ਗਿਆ ਅਤੇ ਪੈਕਿੰਗ ਵੀ ਬਹੁਤ ਵਧੀਆ ਸੀ ਪੂਰਾ ਡੱਬਾ ਵਧੀਆ ਤਰੀਕੇ ਨਾਲ ਪੈਕ ਕੀਤਾ ਗਿਆ ਸੀ ਜਦੋਂ ਮੈਂ ਡੱਬਾ ਖੋਲ੍ਹ ਕੇ ਕੰਨਾਂ ਦੇ ਟੋਪਸ ਟੋਪਸ ਦੇਖੇ ਤਾਂ ਬਹੁਤ ਉਹ ਬਹੁਤ ਵਧੀਆ ਸੀ ਮੈਨੂੰ ਬਹੁਤ ਪਸੰਦ ਆਏ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ